ਗੰਦੇ ਬਰਤਨਾਂ ਨੂੰ ਪਹਿਲਾਂ ਪਾਣੀ ਨਾਲ ਧੋਤਾ ਜਾਂਦਾ ਹੈ ਫਿਰ ਉਸ ਤੋਂ ਬਾਅਦ ਸਾਬਣ ਨਾਲ ਮਾਂਜਿਆ ਜਾਂਦਾ ਹੈ ਅਤੇ ਬਾਅਦ ਵਿੱਚ ਸਾਫ ਪਾਣੀ ਨਾਲ ਭਾਂਡੇ ਧੋ ਦਿੱਤੇ ਜਾਂਦੇ ਹਨ ਤੇਲ ਵਾਲੇ ਬਰਤਨਾਂ ਨੂੰ ਸਾਫ ਕਰਨ ਲਈ ਗਰਮ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਗਰਮ ਪਾਣੀ ਨਾਲ ਬਰਤਨਾਂ ਉੱਤੇ ਲੱਗੀ ਘਿਓ ਦੀ ਥੰਧਿਆਈ ਨੂੰ ਸਾਫ ਆਸਾਨੀ ਨਾਲ ਕੀਤਾ ਜਾਂਦਾ ਹੈ